ਸਾਡੇ ਪਿੰਡ ਦੇ ਟੂਰਨਾਮੈਂਟ ਸਾਡੇ ਪਿੰਡ ਦੇ ਸਰਪੰਚ ਸਾਹਿਬ ਕਰਵਾਉਂਦੇ ਨੇ ਇਹਨਾਂ ਵਿੱਚ ਬਹੁਤ ਸਾਰੀਆਂ ਖੇਡਾਂ ਹੁੰਦੀਆਂ ਹਨ ਖੇਡਾਂ ਵਿੱਚ ਫੁੱਟਬਾਲ ਕੁਸ਼ਤੀ ਕ੍ਰਿਕਟ ਵਾਲੀਬਾਲ ਖੋਖੋ ਇੱਦਾਂ ਦੀਆਂ ਖੇਡਾਂ ਬਹੁਤ ਸਾਰੀਆਂ ਕਰਵਾਈਆਂ ਜਾਂਦੀਆਂ ਹਨ ਅਤੇ ਪਿੰਡ ਦੇ ਪਿੰਡ ਦੇ ਨੌਜਵਾਨ ਇਸ ਟੂਰਨਾਮੈਂਟ ਵਿੱਚ ਭਾਗ ਲੈਂਦੇ ਹਨ ਅਤੇ ਸਾਡੇ ਇਲਾਕੇ ਦੇ ਮੰਤਰੀ ਬਹੁਤ ਸਾਰੇ ਪ੍ਰਬੰਧ ਕਰਦੇ ਹਨ ਪ੍ਰਬੰਧ ਵਿੱਚ ਚੇਰਾਂ ਚੇਅਰਾਂ ਦੇ ਪ੍ਰਬੰਧ ਕੀਤੇ ਜਾਂਦੇ ਹਨ ਅਤੇ ਪਾਣੀ ਚਾਹ ਖੇਡਾਂ ਦਾ ਸਮਾਨ ਲਿਆਂਦਾ ਜਾਂਦਾ ਹੈ ਅਤੇ ਸਮਾਨ ਟਰੋਫੀ ਐਂਡ ਟਰੋਫੀਆਂ ਦਿੱਤੀਆਂ ਜਾਂਦੀਆਂ ਨੇ ਸਨਮਾਨ ਕੀਤਾ ਜਾਂਦਾ ਖਿਡਾਰੀਆਂ ਨੂੰ